ਯੋਗਾ ਸਿੱਖਣ ਲਈ ਮੈਂ ਯੋਗ ਗੁਰੂ ਕਦੇ ਕਦੇ ਚੈਨਲ ਨੂੰ ਜ਼ਰੂਰ ਦੇਖਦਾ ਜਿਹਨੂੰ ਬਾਬਾ ਰਾਮਦੇਵ ਜੀ ਚਲਾਉਂਦੇ ਆ ਤਾਂ ਉਹ ਯੋਗਾ ਦੇ ਮਾਹਰ ਕਹਿ ਸਕਦੇ ਆ ਆਪਾਂ ਉਹਨਾਂ ਨੂੰ ਬਟ ਇਸ ਤੋਂ ਬਿਨਾਂ ਮੈਂ ਜੋ ਯੋਗਾ ਟੀਚਰ ਹੈਗੇ ਆ ਉਹਨਾਂ ਦੀਆਂ ਕਲਾਸਾਂ ਵੀ ਲਾਉਨਾ ਅਤੇ ਯੋਗਾ ਸਿੱਖਣ ਨਾਲ ਜਿਹੜੀਆਂ ਮੁਸ਼ਕਿਲਾਂ ਦੀ ਗੱਲ ਜੇ ਆਪਾਂ ਕਰੀਏ ਤਾਂ ਮੁਸ਼ਕਿਲਾਂ ਤਾਂ ਕਿਸੇ ਵੀ ਕੰਮ 'ਚ ਅਸੀਂ ਸ਼ੁਰੂ ਕਰਾਂਗੇ ਤਾਂ ਉਹਦੇ 'ਚ ਆਉਣਗੀਆਂ ਹੀ ਆਉਣਗੀਆਂ ਕਿਉਂਕਿ ਅਸੀਂ ਉਸ ਕੰਮ ਨੂੰ ਕਰਨ ਤੋਂ ਪਹਿਲਾਂ ਉਹ ਕੰਮ ਕੀਤਾ ਨਹੀਂ ਹੁੰਦਾ ਇਸ ਕਰਕੇ ਸਾਨੂੰ ਉਹ ਮੁਸ਼ਕਿਲਾਂ ਆਉਂਦੀਆਂ ਸਾਡਾ ਸਰੀਰ ਹੈ ਜਿਹੜਾ ਉਹ ਲਚਕੀਲਾ ਨਹੀਂ ਹੁੰਦਾ ਅਸੀਂ ਉਸ ਤਰ੍ਹਾਂ ਦੀਆਂ ਜਿਹੜੀਆਂ ਐਕਟੀਵਿਟੀਜ ਹੈ ਜਿਹੜੀਆਂ ਕਸਰਤਾਂ ਉਹ ਨਹੀਂ ਕਰ ਸਕਦੇ ਪਰ ਜੇ ਅਸੀਂ ਕਿਸੇ ਕੰਮ ਨੂੰ ਲਗਾਤਾਰ ਕਰਾਂਗੇ ਵਾਰ ਵਾਰ ਕਰਾਂਗੇ ਅਤੇ ਕਿਸੇ ਵੀ ਕੰਮ ਨੂੰ ਲਗਾਤਾਰ ਕਰਨ ਨਾਲ ਅਤੇ ਵਾਰ ਵਾਰ ਕਰਨ ਨਾਲ ਮਨੁੱਖ ਉਸ ਕੰਮ ਨੂੰ ਸਿੱਖ ਸਕਦਾ ਹਰੇਕ ਬੰਦਾ ਉਸ ਕੰਮ ਨੂੰ ਸਿੱਖ ਸਕਦਾ ਹੈ ਪਰਮਾਤਮਾ ਨੇ ਮਨੁੱਖ ਨੂੰ ਇੱਕ ਇਹੀ ਚੀਜ਼ ਵੱਖਰੀ ਦਿੱਤੀ ਹੈ ਕਿ ਉਹ ਕਿਸੇ ਵੀ ਕੰਮ ਨੂੰ ਸਿੱਖ ਕੇ ਕਰ ਸਕਦਾ ਪਰ ਜਿਹੜੇ ਦੂਜੇ ਪਸ਼ੂ ਪੰਛੀ ਹੈ ਉਹ ਸਿੱਖ ਕੇ ਕਿਸੇ ਕੰਮ ਨੂੰ ਨਹੀਂ ਕਰ ਸਕਦੇ ਅਤੇ ਇਸ ਕਰਕੇ ਯੋਗਾ ਸਿੱਖਣ ਨਾਲ ਮੁਸ਼ਕਿਲਾਂ ਤਾਂ ਆਉਂਦੀਆਂ ਪਰ ਮੁਸ਼ਕਿਲਾਂ ਜਿਹੜੀਆਂ ਆਉਂਦੀਆਂ ਉਹਨਾਂ ਨੂੰ ਸਰ ਕੀਤਾ ਜਾ ਸਕਦਾ ਕੋਈ ਏਡੀ ਵੱਡੀ ਮੁਸ਼ਕਿਲ ਨਹੀਂ ਹੈ ਕਿਉਂਕਿ ਕਿਹਾ ਜਾਂਦਾ ਵੀ ਕਿਸੇ ਵੀ ਕੋਈ ਤਾਲਾ ਨਹੀਂ ਐਸਾ ਜਾਂ ਜਿਹਦੀ ਚਾਬੀ ਨਾ ਹੋਵੇ ਹਰੇਕ ਸਮੱਸਿਆ ਦਾ ਹੱਲ ਹੁੰਦਾ ਅਤੇ ਯੋਗਾ ਸਿੱਖਣ ਲਈ ਜਿਹੜੀਆਂ ਆਉਂਦੀਆਂ ਮੁਸ਼ਕਿਲਾਂ ਉਹ ਹੱਲ ਹੋ ਸਕਦੀਆਂ ਇਹ ਕੋਈ ਬਹੁਤ ਵੱਡੀਆਂ ਮੁਸ਼ਕਿਲਾਂ ਨਹੀਂ ਹੈ ਪਰ ਸਾਨੂੰ ਲਗਾਤਾਰ ਪ੍ਰੈਕਟਿਸ ਕਰਨੀ ਪਏਗੀ ਵਾਰ ਵਾਰ ਪ੍ਰੈਕਟਿਸ ਕਰਨੀ ਪਏਗੀ ਅਤੇ ਵਾਰ ਵਾਰ ਕਰਨ ਵਾਸਤੇ ਲਗਾਤਾਰ ਕਰਨ ਨਾਲ ਅਸੀਂ ਯੋਗਾ ਸਿੱਖਣ ਦੀਆਂ ਜਿਹੜੀਆਂ ਮੁਸ਼ਕਿਲਾਂ ਆਉਂਦੀਆਂ ਉਹਨਾਂ ਨੂੰ ਸਰ ਕਰ ਸਕਦੇ ਹਾਂ ਅਤੇ ਇਸ ਯੋਗਾ ਸਿੱਖਣ ਦੇ ਕੰਮ ਦੇ ਵਿੱਚ ਵਧੀਆ ਤਰੀਕੇ ਦੇ ਨਾਲ ਕਾਮਯਾਬ ਹੋ ਸਕਦੇ ਹਾਂ ਅਤੇ ਅੱਗੇ ਵੱਧ ਸਕਦੇ ਹਾਂ